ਮੈਂ ਵਰਿੰਦਰ ਕੁਮਾਰ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਮਨਪਸੰਦ ਕਿਤਾਬਾਂ ਵਿੱਚੋਂ ਪੰਜਾਬੀ ਦੀ ਪੁਸਤਕ ਪੂਰਨ ਭਗਤ ਲਿਖਤ ਕਾਦਰਯਾਰ ਹੈ ਇਸ ਦੀ ਰਚਨਾ ਨੇ ਮੈਨੂੰ ਬੜਾ ਹੀ ਪ੍ਰਭਾਵਿਤ ਕੀਤਾ ਇਸ ਕਰਕੇ ਮੈਂ ਪੰਜਾਬੀ ਵਿਸ਼ੇ ਵਿੱਚ ਐਮ ਏ ਪਾਸ ਕੀਤੀ ਅਤੇ ਅੱਜ ਮੈਂ ਕਵਿਤਾ ਨੂੰ ਬੜੇ ਹੀ ਵਧੀਆ ਅੰਦਾਜ਼ ਨਾਲ਼ ਪੜ੍ਹਦਾ ਹਾਂ ਮੇਰੀ ਮਨਪਸੰਦ ਪੁਸਤਕ ਇਹ ਹੋਣ ਕਰਕੇ ਮੈਨੂੰ ਕਵਿਤਾਵਾਂ ਦਾ ਬੜਾ ਹੀ ਸ਼ੌਕ ਹੈ ਇਹ ਪੁਸਤਕ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੈਂ ਇਸ ਨੂੰ ਜ਼ੁਬਾਨੀ ਯਾਦ ਰੱਖਦਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਦੀ ਆਪਣੀ ਆਪਣੀ ਮਨਪਸੰਦ ਚੀਜ਼ ਹੁੰਦੀ ਹੈ ਇਸ ਤਰ੍ਹਾਂ ਮੇਰੀ ਮੇਰੀ ਮੈਨੂੰ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ ਕਵਿਤਾਵਾਂ ਪੜ੍ਹਨ ਨਾਲ਼ ਇਨਸਾਨ ਦੇ ਅੰਦਰ ਰੂਹਾਨੀਅਤ ਜਾਗਦੀ ਹੈ ਉਸ ਨੂੰ ਉਸ ਰੂਹਾਨੀਅਤ ਬਾਰੇ ਪਤਾ ਲੱਗਦਾ ਹੈ ਅਤੇ ਅੰਦਰੂਨੀ ਜਗਿਆਸਾ ਜਿਹੜੀ ਆ ਉਹ ਪੜ੍ਹਨ ਦੀ ਉਹ ਜਾਗਦੀ ਹੈ ਅਤੇ ਸਾਨੂੰ ਆਪੇ ਵੀ ਕਵਿਤਾਵਾਂ ਜਾਂ ਹੋਰ ਸੱਭਿਆਚਾਰ ਨੂੰ ਪੜ੍ਹਨਾ ਚਾਹੀਦਾ ਹੈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਵੀ ਕਵਿਤਾਵਾਂ ਨੂੰ ਵੱਧ ਤੋਂ ਵੱਧ ਪੜ੍ਹਿਆ ਜਾਵੇ ਆਪਣੇ ਸੱਭਿਆਚਾਰ ਨਾਲ਼ ਜੁੜਿਆ ਜਾਵੇ ਆਪਾਂ ਜਿੰਨਾ ਹੀ ਕਵਿਤਾਵਾਂ ਪੜ੍ਹਾਂਗੇ ਓਨਾਂ ਹੀ ਰੂਹਾਨੀਅਤ ਨਾਲ਼ ਮੇਲ ਕਰਾਂਗੇ ਧੰਨਵਾਦ